ਜਿਹੜੀ ਪੰਜਾਬੀ ਲੈਂਗੁਏਜ ਹੈ ਇਹ ਆਪਣੀ ਮਾਤ ਭਾਸ਼ਾ ਏ ਇੱਕ ਇਹ ਆਪਣੀ ਮਦਰ ਟੰਗ ਆ ਠੀਕ ਹੈ ਨਾ ਮਤਲਬ ਜਿੱਦਾਂ ਆਪਣੇ ਉਹਦੇ ਵਿੱਚ ਲੋਕ ਜਿਉਂ ਜਿਉਂ ਲੋਕਾਂ ਦੀ ਤਰੱਕੀ ਹੋਈ ਜਾਂਦੀ ਆ ਉੱਦਾਂ ਉੱਦਾਂ ਮਤਲਬ ਲੋਕ ਮਤਲਬ ਜ਼ਿਆਦਾਤਰ ਫੋਰਨ ਲੈਂਗੁਏਜਾਂ ਦੀ ਲੈਂਗੁਏਜ ਯੂਜ਼ ਕਰਦਾ ਜਿਵੇਂ ਇੰਗਲਿਸ਼ ਹੋ ਗਿਆ ਹਿੰਦੀ ਹੋ ਗਿਆ ਆਪਣੇ ਜਿਹੜੀਆਂ ਕੰਮ ਵਾਲੀਆਂ ਥਾਵਾਂ ਨੇ ਉੱਥੇ ਹੈ ਨਾ ਮੇਨਲੀ ਇੰਗਲਿਸ਼ ਅਤੇ ਹਿੰਦੀ ਓ ਯੂਜ਼ ਹੁੰਦੀ ਆ ਔਫਿਸ ਵਗੈਰਾ 'ਚ ਅਤੇ ਇਸ ਕਰਕੇ ਹੈ ਨਾ ਜਿਹੜੀ ਪੰਜਾਬੀ ਲੈਂਗੁਏਜ ਆ ਇਹਨੂੰ ਲੋਕ ਘੱਟ ਯੂਜ਼ ਕਰਨ ਲੱਗ ਗਏ ਜਿਹੜੇ ਮਤਲਬ ਲੋਕ ਪੰਜਾਬੀ ਯੂਜ਼ ਕਰਦੇ ਆ ਉਹਨਾਂ ਨੂੰ ਕਹਿੰ ਲੋਕ ਅਨਪੜ੍ਹ ਮੰਨਦੇ ਆ ਵੀ ਹਾਂ ਇਹ ਅਨਪੜ੍ਹ ਹੈ ਇਹ ਪੇਂਡੂ ਹੈ ਇਸ ਕਰਕੇ ਜਿਹੜੀ ਪੰਜਾਬੀ ਲੈਂਗੁਏਜ ਹੈ ਉਹ 'ਤੇ ਬਹੁਤ ਹੀ ਬਹੁਤ ਬੁਰਾ ਪ੍ਰਭਾਵ ਪਿਆ ਏ ਜਿਹੜੀ ਆਪਣੀ ਪੰਜਾਬੀ ਲੈਂਗੁਏਜ ਹੈ ਅਤੇ ਹੈ ਨਾ ਜਿਵੇਂ ਸਕੂਲਾਂ ਵਿੱਚ ਜਿਹੜੇ ਸਟੂਡੈਂਟਸ ਹੁੰਦੇ ਨੇ ਉਹਨਾਂ ਨੂੰ ਜ਼ਿਆਦਾਤਰ ਹਿੰਦੀ ਹਿੰਦੀ ਵਿੱਚ ਗੱਲ ਕਰੀ ਜਾਂਦੀ ਆ ਜਾਂ ਇੰਗਲਿਸ਼ ਵਿੱਚ ਗੱਲ ਕਰੀ ਜਾਂਦੀ ਆ ਪੰਜਾਬੀ ਬੋਲਣੀ ਮਤਲਬ ਓਹ ਨਹੀਂ ਸਿਖਾਉਂਦੇ ਗੇ ਛੋਟੀਆਂ ਕਲਾਸਾਂ ਤੋਂ ਆਪਾਂ ਨੂੰ ਪਹਿਲਾਂ ਹਿੰ ਇੰਗਲਿਸ਼ ਹੁੰਦੀ ਆ ਹਿੰਦੀ ਹੁੰਦੀ ਆ ਅਤੇ ਪੰਜਾਬੀ ਲੈਂਗੁਏਜ ਫਿਰ ਬੜੀਆਂ ਕਲਾਸਾਂ 'ਚ ਆਉਂਦੀ ਆ ਇਸ ਲਈ ਜਿਹੜੀ ਇਹ ਮਤਲਬ ਇਹਦੇ ਅਨਪੜ੍ਹਤਾ ਜਾਂ ਕਹਿ ਦਿੰਦੇ ਆ ਲੋਕ ਵੀ ਹੈ ਨਾ ਪੜ੍ਹਿਆ ਲਿਖਿਆ ਨਹੀਂ ਗਾ ਇਸ ਲਈ ਪੰ ਜਿਹੜੀ ਹੈ ਨਾ ਉਹਦੀ ਪੰਜਾਬੀ ਲੈਂਗੁਏਜ ਆ ਉਹਦਾ ਯੂਜ਼ ਘੱਟ ਹੋਣ ਲੱਗ ਗਿਆ ਅਤੇ ਜ ਹੈ ਨਾ ਮਤਲਬ ਲੋਕ ਅਨਪੜ੍ਹ ਸਮਝਦੇ ਹਿੰਦੀ ਜਾਂ ਇੰਗਲਿਸ਼ ਦੀ ਜਿਹੜੀ ਵਰਤੋਂ ਆ ਉਹ ਜ਼ਿਆਦਾ ਹੋਣ ਲੱਗੀ ਅੱਜ ਦੇ ਯੁੱਗ ਵਿੱਚ ਇਸ ਕਰਕੇ ਜਿਹੜਾ ਪੰਜਾਬੀ ਬੋਲੀ 'ਤੇ ਆ ਉਹ ਬਹੁਤ ਡੂੰਘਾ ਪ੍ਰਭਾਵ ਪਿਆ ਏ ਕਿ ਹੈ ਨਾ ਲੋਕ ਆਪਣੇ ਲੋਕ ਪੰਜਾਬੀ ਬੋਲਣਗੇ ਉਹ ਕਹੇਗਾ ਅਗਲਾ ਮੈਨੂੰ ਅਨਪੜ੍ਹ ਸਮਝਦਾ